ਹੈਲੋ ਐਮਾਜੋਨ ਤੋਂ ਬੋਲ ਰਹੇ ਜੀ ਹਾਂਜੀ ਜੀ ਮੈਂ ਤੁਹਾਨੂੰ ਤੁਹਾਡੇ ਇੱਥੋਂ ਸੂਟ ਮੰਗਾਇਆ ਸੀ ਅਤੇ ਉਹ ਬਹੁਤ ਵਧੀਆ ਨਿਕਲਿਆ ਹੈ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਇੰਨਾ ਅੱਛਾ ਪ੍ਰੋਡਕਟ ਸੀ ਉਹ ਉਹਦਾ ਸਟੱਫ ਬਹੁਤ ਸਭ ਕੁਛ ਬਹੁਤ ਵਧੀਆ ਸੀ ਮੈਨੂੰ ਬਹੁਤ ਮੈਂ ਬਹੁਤ ਲਾਈਕ ਕੀਤਾ ਮੈਂ ਅੱਗੇ ਤੋਂ ਵੀ ਤੁਹਾਡੇ ਤੋਂ ਹੀ ਮੰਗਵਾਵਾਂਗੀ ਥੈਂਕ ਯੂ ਜੀ ਥੈਂਕ ਯੂ ਸੋ ਮਚ